ਅੱਜ ਕੱਲ੍ਹ ਬਹੁਤ ਨਵੇਂ ਨਵੇਂ ਤਰੀਕੇ ਦੀਆਂ ਵੀਡੀਓ ਗੇਮਾਂ ਆਈ ਆ ਰਹੀਆਂ ਹੈ ਕਿਹਦੇ ਕਰਕੇ ਬੱਚੇ ਆਪਣਾ ਮਾਇੰਡ ਫਰੈਸ਼ ਕਰ ਸਕਦੇ ਆ ਪੁਰਾਣੇ ਸਮੇਂ ਦੇ ਵਿੱਚ ਬਹੁਤ ਘੱਟ ਵੀਡੀਓ ਗੇਮਾਂ ਹੁੰਦੀਆਂ ਸੀਗੀਆਂ ਮੈਂ ਅਕਸਰ ਆਪਣੇ ਵਿਹਲੇ ਟਾਈਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਵੀਡੀਓ ਗੇਮ ਖੇਡਦਾ ਹੈ ਪਰ ਜ਼ਿਆਦਾਤਰ ਮੈਂ ਆਪਣੇ ਵਿਹਲੇ ਟਾਈਮ ਦੇ ਵਿੱਚ ਬੈਟਲ ਗਰਾਊਂਡ ਮੋਬਾਇਲ ਇੰਡੀਆ ਖੇਡਦਾ ਹੈ ਕਿਉਂਕਿ ਉਹ ਮੇਰਾ ਬਹੁਤ ਵਧੀਆ ਗੇਮ ਆ ਅਤੇ ਉਹ ਕਦੋਂ ਵੀ ਮੈਂ ਗੇਮ ਖੇਡਦਾ ਅਤੇ ਮੇਰਾ ਦਿਮਾਗ ਫਰੈਸ਼ ਹੋ ਜਾਂਦਾ ਉਹਦੇ ਵਿੱਚ ਗੇਮ ਦੇ ਵਿੱਚ ਜ਼ਿਆਦਾਤਰ ਆਪਾਂ ਬੰਦੇ ਲੱਭਣੇ ਹੁੰਦੇ ਆ ਅਤੇ ਲੱਭ ਕੇ ਉਹਨਾਂ ਨੂੰ ਫਿਨਿਸ਼ ਕਰਨਾ ਹੁੰਦਾ ਉਹਦੇ ਕਾਰਨ ਆਪਣੀ ਆਰ ਪੀ ਵਗੈਰਾ ਵੀ ਵੱਧਦੀ ਹੈ ਵੀਡੀਓ ਗੇਮ ਇੱਕ ਬਹੁਤ ਵਧੀਆ ਤਰੀਕਾ ਹੈ ਜਿਹਦੇ ਨਾਲ ਆਪਣਾ ਮਾਇੰਡ ਫਰੈਸ਼ ਹੁੰਦਾ ਹੈ ਵੀਡੀਓ ਗੇਮ ਖੇਡਣ ਨਾਲ ਆਪਾਂ ਬੜੀ ਅਲੱਗ ਅਲੱਗ ਚੀਜ਼ਾਂ ਵੀ ਸਿੱਖ ਸਕਦੇ ਹਾਂ ਪਹਿਲਾਂ ਤਾਂ ਮੇਨ ਫ਼ਾਇਦਾ ਹੁੰਦਾ ਵੀਡੀਓ ਗੇਮ ਖੇਡਣ ਦਾ ਇਹ ਕਿ ਆਪਣਾ ਮਾਇੰਡ ਸ਼ਾਰਪ ਹੁੰਦਾ ਹੈ ਅਤੇ ਦੂਜੀ ਗੱਲ ਵੀਡੀਓ ਗੇਮ ਖੇਡਣ ਨਾਲ ਆਪਣਾ ਜਿਹੜਾ ਡਿਪਰੈਸ਼ਨ ਡੁਪਰੈਸ਼ਨ ਉਹ ਵੀ ਦੂਰ ਹੋ ਜਾਂਦਾ ਹੈ ਅੱਜ ਕੱਲ੍ਹ ਬਹੁਤ ਅਲੱਗ ਅਲੱਗ ਤਰ੍ਹਾਂ ਦੀ ਵੀਡੀਓ ਗੇਮਾਂ ਆ ਰਹੀਆਂ ਹੈ ਕਿਹਦੇ ਕਰਕੇ ਵੀਡੀਓ ਗੇਮ ਵੀ ਕਿਹਦੇ ਕਰਕੇ ਬੱਚੇ ਆਪਣਾ ਫਰੀ ਟਾਈਮ ਉਹਨਾਂ ਦੇ ਸਪੈਂਡ ਕਰ ਸਕਦੇ ਆ ਵੀਡੀਓ ਗੇਮਾਂ 'ਤੇ ਅਤੇ ਵੀਡੀਓ ਗੇਮ ਇੱਕ ਬਹੁਤ ਵਧੀਆ ਚੀਜ਼ ਹੈ ਨਵੀਂ ਨਵੀਂ ਚੀਜ਼ਾਂ ਸਿੱਖਣ ਨੂੰ ਅਤੇ ਕੁਛ ਕੁ ਵੀਡੀਓ ਗੇਮਾਂ ਇਹੋ ਜਿਹੀਆਂ ਵੀ ਆ ਜਿੱਥੇ ਬੱਚੇ ਪੈਸੇ ਕਮਾ ਸਕਦੇ ਆ ਅਤੇ ਆਪਣੇ ਘਰਦਿਆਂ ਨੂੰ ਦੇਖ ਸਕਦੇ ਹੈ ਬਿਨਾਂ ਬਿਨਾਂ ਕਿਸੇ ਤਰ੍ਹਾਂ ਵੀ ਪੈਸੇ ਲਾਏ ਤੋਂ ਵੀਡੀਓ ਗੇਮਾਂ ਬਹੁਤ ਵਧੀਆ ਚੀਜ਼ਾਂ ਹੈ ਅਤੇ ਜ਼ਿਆਦਾਤਰ ਲੋਕ ਵੀਡੀਓ ਗੇਮਾਂ ਮੋਬਾਈਲਾਂ 'ਤੇ ਖੇਡੇਣ ਨੂੰ ਪਸੰਦ ਕਰਦੇ ਆ ਕਿਉਂਕਿ ਉਹ ਬਹੁਤ ਜ਼ਿਆਦਾ ਸਿੰਪਲ ਹੁੰਦਾ ਅਤੇ ਉਹਨਾਂ ਨੂੰ ਇੰਨਾ ਟਾਈਮ ਨਹੀਂ ਲੱਗਦਾ ਕੁਛ ਵੀ ਡਾਊਨਲੋਡ ਕਰਨ ਨੂੰ ਅਤੇ ਇੱਥੇ ਬੜੀ ਅਲੱਗ ਅਲੱਗ ਤਰ੍ਹਾਂ ਦੀਆਂ ਵੀਡੀਓ ਗੇਮਾਂ ਹੁੰਦੀਆਂ ਜ਼ਿਆਦਾਤਰ ਪਲੇਅ ਸਟੋਰ ਅਤੇ ਐਪ ਸਟੋਰ 'ਤੇ ਪੇਡ ਵੀਡੀਓ ਗੇਮਸ ਵੀ ਹੁੰਦੀਆਂ ਹੈ ਜਿਹੜੀ ਹਾਈ ਟੈਕਨੋਲੋਜੀ 'ਤੇ ਹੋਵੇ ਅਤੇ ਉਹਨਾਂ ਦੇ ਪਿਕਸਲ ਵਧੀਆ ਹੋਣ ਪਰ ਕੁਛ ਕੁ ਵੀਡੀਓ ਗੇਮਾਂ ਫਰੀ ਵੀ ਹੁੰਦੀਆਂ ਪਲੇਅ ਸਟੋਰ ਦੇ ਵਿੱਚ ਕਿਹੜੇ ਵੀ ਬਹੁਤ ਵਧੀਆ ਕੁਆਲਿਟੀ ਦੀ ਹੁੰਦੀਆਂ ਹੈ ਅਤੇ ਵੀਡੀਓ ਗੇਮ ਖੇਡਣ ਦਾ ਜ਼ਿਆਦਾਤਰ ਦੋ ਕੁ ਹੀ ਰੀਜਨ ਹੁੰਦੇ ਆ ਕਿਉਂਕਿ ਫਸਟ ਜ਼ਿਆਦਾਤਰ ਦੋ ਕੁ ਰੀਜਨ ਹੁੰਦੇ ਆ ਕਿ ਬੰਦਾ ਆਪਣਾ ਮਾਇੰਡ ਫਰੈਸ਼ ਕਰ ਸਕਦਾ ਹੈ ਅਤੇ ਦੂਜੀ ਗੱਲ ਐਵੇਂ ਆ ਵੀਡੀਓ ਗੇਮਾਂ ਖੇਡਣ ਨਾਲ ਬੰਦੇ ਦਾ ਮਾਇੰਡ ਸ਼ਾਰਪ ਹੋਜੂਗਾ ਅਤੇ ਉਹ ਨਵੀਂਆਂ ਨਵੀਂਆਂ ਚੀਜ਼ਾਂ ਸਿੱਖੂਗਾ